ਹਾਂਜੀ ਮੇਰਾ ਅਨੁਭਵ ਇੱਕ ਹੈ ਜੋ ਕਿ ਨਿਊਜ ਮੀਡੀਆ ਪ੍ਰਸ਼ਾਸਨ ਅਤੇ ਸਰਕਾਰ ਦੀ ਗਤੀਵਿਧੀ ਮੈਨੂੰ ਆਪਣੇ ਜੋਬ ਲੈਣ ਦੇ ਵਿੱਚ ਹਰ ਤਰ੍ਹਾਂ ਹੈਲਪ ਕਰਦੀ ਹੈ ਨਵੇਂ ਨਵੇਂ ਐਡਵਰਟਾਈਜਮੈਂਟ ਕੱਢ ਕੇ